ਪੰਜਾਬ ਦੇ ਵਿੱਚ ਬਹੁਤ ਸਾਰੀਆਂ ਖੇਲ ਅਕੈਡਮੀਆਂ ਆ ਜਿਵੇਂ ਫੁੱਟਬਾਲ ਅਕੈਡਮੀ ਅਤੇ ਰਾਮਗੜੀਆ ਅਤੇ ਨਵਾਂਸ਼ਹਿਰ ਦੇ ਵਿੱਚ ਹੈ ਕ੍ਰਿਕਟ ਖੇਡ ਅਕੈਡਮੀ ਆ ਚੰਡੀਗੜ੍ਹ ਦੇ ਵਿੱਚ ਖੇਲ ਅਕੈਡਮੀ ਆ ਜਲੰਧਰ ਵਿੱਚ ਖੇਲ ਅਕੈਡਮੀਆਂਂ ਆ ਫੁੱਟਬੋਲ ਕ੍ਰਿਕਟ ਵੋਲੀਬੋਲ ਟੈਨਿਸ ਇਹ ਸਾਰੀਆਂ ਖੇਲ ਅਕੈਡਮੀਆਂ ਹੈ ਜਿਹੜੀਆਂ ਸਾਡੇ ਪੰਜਾਬ ਨੂੰ ਸਿਹਤਮੰਦ ਅਤੇ ਖੁਸ਼ਲ ਰਹਿਣ ਲਈ ਸਾਨੂੰ ਬਣਾਈਆਂ ਹੋਈਆਂ ਹਨ ਸਾਡਾ ਜਿਹੜਾ ਯੁਵਾ ਕੇਂਦਰ ਆ ਸਾਡੇ ਜਵਾਨ ਆ ਉਹਨਾਂ ਨੂੰ ਸਿਹਤਮੰਦ ਸਿੱਖਿਆ ਮਿਲੇ